ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕਨਿਕਸ਼ਾ ਰਾਣੀ ਬੋਲ ਰਹੀ ਹਾਂ ਤੁਸੀਂ ਬਰਾੜ ਸਵੀਟਸ ਤੋਂ ਬੋਲ ਰਹੇ ਹੋ ਠੀਕ ਹੈ ਮੈਨੇ ਤੁਹਾਡੇ ਕੋਲ ਆਰਡਰ ਬੁੱਕ ਕਰਵਾਉਣਾ ਸੀਗਾ ਸ਼ਾਮ ਨੂੰ ਨਾ ਮੇਰੇ ਬ੍ਰਦਰ ਦੀ ਬਰਡੇ ਪਾਰਟੀ ਹੈ ਇਸ ਲਈ ਮੈਨੂੰ ਬਰਗਰ ਪੀਜ਼ਾ ਸੈਂਡਵਿਚ ਹੋਡੋਗ ਬਰਫੀ ਰਸਮਲਾਈ ਕਾਜੂ ਕਤਲੀ ਚਾਹੀਦੀਆਂ ਸੀਗੀਆਂ ਇਸ ਲਈ ਮੈਨੇ ਆਰਡਰ ਬੁੱਕ ਕੀਤਾ ਹੈਗਾ ਤੁਸੀਂ ਐਂ ਕਰਿਓ ਸ਼ਾਮ ਨੂੰ ਪੰਜ ਵਜੇ ਤੱਕ ਜੇ ਹੋ ਸਕੇ ਭੇਜ ਦਿਓ ਕਿਉਂਕਿ ਇਸ ਤੋਂ ਪਹਿਲਾਂ ਮਹਿਮਾਨ ਆਉਣੇ ਸ਼ੁਰੂ ਹੋ ਜਾਣਗੇ ਠੀਕ ਹੈ ਵੈਸੇ ਤੁਸੀਂ ਇੰਨੇ ਸਾਰੇ ਸਮਾਨ 'ਤੇ ਕਿੰਨੀ ਕੁ ਪਰਸੈਂਟ ਦਾ ਡਿਸਕਾਊਂਟ ਦੇ ਸਕਦੇ ਹੋ ਟਵੰਟੀ ਪਰਸੈਂਟ ਠੀਕ ਹੈ ਅਤੇ ਇਸ ਸਮਾਨ ਦਾ ਬਿੱਲ ਵੀ ਨਾਲ ਹੀ ਭੇਜੋਂਗੇ ਠੀਕ ਹੈ ਜੀ ਅਤੇ ਪੇਮੈਂਟ ਪੇਮੈਂਟ ਤੁਹਾਨੂੰ ਆਨਲਾਈਨ ਕਰ ਦੇਈਏ ਜਾਂ ਕੈਸ਼ ਰਾਹੀਂ ਠੀਕ ਹੈ ਔਨਲਾਈਨ ਹੀ ਕਰ ਦੇਈਏ ਠੀਕ ਹੈ ਜੀ ਅਤੇ ਪਲੀਜ਼ ਇੱਕ ਰਿਕੁਐਸਟ ਹੈ ਬਸ ਤੁਸੀਂ ਸਮਾਨ ਸਹੀ ਟਾਈਮ 'ਤੇ ਪਹੁੰਚਾ ਦਿਓ ਨਹੀਂ ਜੇ ਮਹਿਮਾਨ ਆਉਣੇ ਸ਼ੁਰੂ ਹੋ ਗਏ ਇਸ ਤੋਂ ਬਾਅਦ ਤਾਂ ਸਮਾਨ ਬਾਅਦ 'ਚੋਂ ਆਵੇ ਵਧੀਆ ਨਹੀਂ ਲੱਗਦਾ ਨਾ ਅਤੇ ਬਾਕੀ ਮੈਨੇ ਸੁਣਿਆ ਤੁਹਾਡੀ ਸ਼ੋਪ ਬਾਰੇ ਬਹੁਤ ਵੀ ਇਥੇ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਮਿਲਦੀਆਂ ਨੇ ਇਸ ਲਈ ਮੈਨੇ ਕਿਹਾ ਵੀ ਚੱਲੋ ਬਰ ਬਰਦਰ ਦੀ ਬਰਡੇ ਪਾਰਟੀ ਹੈ ਔਡਰ ਬੁੱਕ ਕਰੀਏ ਅ ਤੇ ਮੈਨੂੰ ਇਹ ਸਾਰਾ ਸਮਾਨ ਵਧੀਆ ਮਟੀਰੀਅਲ 'ਚ ਵਧੀਆ ਪੈਕਜਿੰਗ 'ਚ ਚਾਹੀਦਾ ਹੈਗਾ ਪਲੀਜ਼ ਕਿਵੇਂ ਵੀ ਕਰਕੇ ਤੁਸੀਂ ਸਮਾਨ ਅਰੇਂਜ ਕਰ ਦਿਓ ਅਗਰ ਪੋਸੀਬਲ ਨਹੀਂ ਹੋ ਪਾ ਰਿਹਾ ਤਾਂ ਪਲੀਜ਼ ਮੈਨੂੰ ਪਹਿਲਾਂ ਦੱਸ ਦਿਓ ਅਤੇ ਅਰੇਂਜ ਕਰਕੇ ਦੇ ਦਿਓ ਮੈਨੂੰ ਚਾਹੀਦਾ ਹੈਗਾ ਔਡਰ ਪੰਜ ਵਜੇ ਤੱਕ ਠੀਕ ਹੈ ਅਤੇ ਜੇ ਸੋਸ ਹੁੰਦੀ ਆ ਨਾ ਜਿਹੜੀ ਆਪਣੀ ਥੋੜ੍ਹੀ ਜਿਹੀ ਐਕਸਟਰਾ ਭੇਜ ਦਿਉ ਬਾਕੀ ਇੱਕ ਮੈਨੇ ਚੋਕਲੇਟ ਕੇਕ ਵੀ ਆਰਡਰ ਕਰਵਾਉਣਾ ਸੀ ਤੁਹਾਡੇ ਇੱਥੇ ਚੋਕਲੇਟ ਕੇਕ ਬਣਦਾ ਹੈਗਾ ਠੀਕ ਹੈ ਉਸ 'ਤੇ ਐਕਸਟਰਾ ਥੋੜ੍ਹੀ ਜਿਹੀ ਕਰੀਮ ਲਗਾ ਦਿਓ ਠੀਕ ਹੈ ਬਾਕੀ ਬਿੱਲ ਪਲੀਜ਼ ਨਾਲ ਭੇਜ ਦਿਓ ਇਹਦੇ ਪੇਮੈਂਟ ਥੋੜ੍ਹੀ ਜਿਹੀ ਹੋ ਸਕਿਆ ਮੈਂ ਕੈਸ਼ ਰਾਹੀਂ ਕਰ ਦੂੰ ਬਾਕੀ ਤੁਹਾਨੂੰ ਚੈੱਕ ਦੇ ਦੂੰ ਜਾਂ ਫਿਰ ਗੂਗਲ ਪੇ ਰਾਹੀਂ ਆਪਾਂ ਔਨਲਾਈਨ ਮੋਡ 'ਚ ਕਰ ਦਾਂਗੇ ਠੀਕ ਹੈ ਜੀ ਥੈਂਕ ਯੂ ਜੀ ਸ਼ਾਮ ਨੂੰ ਠੀਕ ਹੈ ਠੀਕ ਹੈ ਓਕੇ ਥੈਂਕ ਯੂ ਸ਼ਾਮ ਨੂੰ ਪਹੁੰਚਾ ਦਿਓ ਠੀਕ ਹੈ